ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਵਧੀਆ ਗੱਲ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਸਾਡੀ ਜਿਹੜੀ ਕੰਪਨੀ ਹੈ ਜੀ ਬਹੁਤ ਵਧੀਆ ਕੰਪਨੀ ਹੈਗੀ ਹੈ ਅਤੇ ਬਾਕੀ ਸਾਡੇ ਕੋਲ ਪੂਰੇ ਡਾਕੂਮੈਂਟ ਹੈ ਜੋ ਸਰਕਾਰ ਵੱਲੋਂ ਨਿਰਧਾਰਿਤ ਕੀਤੇ ਗਏ ਹੈਗੇ ਹੈ ਲਾਇਸੈਂਸ ਲਿਆ ਹੋਇਆ ਸਾਡਾ ਉਹਦੇ ਨਾਲ ਕੀ ਹੈ ਵੀ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਵੇਗੀ ਜੀ ਠੀਕ ਹੈ ਜੀ ਅਤੇ ਅਸੀਂ ਇਹਦੇ ਲਈ ਤੁਹਾਡਾ ਹੋਟਲ ਦਾ ਵੀ ਪ੍ਰਬੰਧ ਕਰ ਦੇਵਾਂਗੇ ਰਹਿਣ ਸਹਿਣ ਦਾ ਵਧੀਆ ਹੋਟਲ ਹੋਣਗੇ ਅਤੇ ਤੁਹਾਨੂੰ ਗੱਡੀ ਵੀ ਪ੍ਰੋਵਾਈਡ ਕਰਾ ਦਿੱਤੀ ਜਾਵੇਗੀ ਜਿੱਥੇ ਵੀ ਤੁਸੀਂ ਘੁੰਮਣਾ ਅਤੇ ਜਿਹੜਾ ਡਰਾਈਵਰ ਹੈ ਸਾਡੇ ਉਹ ਵੀ ਲਾਇਸੈਂਸ ਹੋਲਡਰ ਹੈ ਪੂਰੀ ਵਰਦੀ 'ਚ ਰਹਿਣਗੇ ਅਤੇ ਜਿੱਦਾਂ ਵੀ ਤੁਹਾਡੇ ਨਾਲ਼ ਤੁਸੀਂ ਕਹੋਂਗੇ ਪੂਰਾ ਸਹਿਯੋਗ ਕਰਨਗੇ ਉਹ ਤੁਹਾਡੇ ਨਾਲ਼ ਹਾਂਜੀ ਰੋਪੜ ਡਿਸਟ੍ਰਿਕਟ ਦੇ ਵਿੱਚ ਆਨੰਦਪੁਰ ਸਾਹਿਬ ਹੈ ਜੀ ਅਤੇ ਉੱਥੇ ਵਿਰਾਸਤ ਏ ਖਾਲਸਾ ਹੈ ਅਤੇ ਉੱਥੇ ਉਹ ਦੇਖਿਆ ਜਾ ਸਕਦਾ ਹੈਗਾ ਅਤੇ ਤਖ਼ਤ ਹੈਗੇ ਤਖ਼ਤ ਦੇਖੇ ਜਾ ਜਾ ਸਕਦੇ ਹਨ ਤਲਵੰਡੀ ਸਾਬੋਂ ਬਠਿੰਡਾ ਉੱਥੇ ਤਖ਼ਤ ਹੈ ਉਹ ਦੇਖੇ ਜਾ ਸਕਦੇ ਹਨ ਅਤੇ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਉੱਥੇ ਤੁਹਾਨੂੰ ਲੈ ਕੇ ਜਾਵੇਗਾ ਸਾਡਾ ਬੰਦਾ ਅਤੇ ਹੋਰ ਜਿਹੜੀ ਵੀ ਥਾਵਾਂ ਹਨ ਚੱਪੜ ਚਿੜੀ ਹੈ ਮੋਹਾਲੀ ਡਿਸਟ੍ਰਿਕਟ ਦੇ ਵਿੱਚ ਉਹ ਵੀ ਤੁਹਾਨੂੰ ਦਿਖਾ ਦਿੱਤੀ ਜਾਵੇਗੀ ਇੰਨਾ ਵੀ ਮਤਲਬ ਵਧੀਆ ਤੋਂ ਵਧੀਆ ਸਰਵਿਸ ਤੋਂ ਸੈਟਿਸਫਾਈਡ ਹੋ ਕੇ ਜਾਓ ਅਤੇ ਹੋਰ ਲੋਕਾਂ ਨੂੰ ਵੀ ਤਾਂ ਕਿ ਤੁਸੀਂ ਦੱਸ ਸਕੋ ਠੀਕ ਸਤਿ ਸ਼੍ਰੀ ਅਕਾਲ